ਮੈਂ ਇੱਥੇ ਦਾ ਸਥਾਨਕ ਨਿਵਾਸੀ ਬੋਲ ਰਿਹਾ ਹਾਂ ਮੈਨੂੰ ਕੈਬ ਮੈਨੂੰ ਆਪਣੀ ਕੈਬ ਨੂੰ ਰੱਦ ਕਰਵਾਉਣਾ ਹੈ ਕਿਉਂਕਿ ਡਰਾਈਵਰ ਆਪਣੇ ਨਿਰਧਾਰਿਤ ਸਮੇਂ 'ਤੇ ਇੱਥੇ ਨਹੀਂ ਪਹੁੰਚ ਰਿਹਾ ਹੈ ਮੈਂ ਪਿਛਲੇ ਇੱਕ ਘੰਟੇ ਤੋਂ ਇੱਥੇ ਖੜ੍ਹਾ ਵੇਟ ਕਰ ਰਿਹਾ ਹਾਂ ਇੰਨੀ ਧੁੱਪ ਵਿੱਚ ਮੈਂ ਵੇਟ ਕਰ ਰਿਹਾ ਪਰ ਡਰਾਈਵਰ ਪਤਾ ਨਹੀਂ ਕਿੱਥੇ ਮੈਂ ਉਹਨੂੰ ਕਾਲ ਵੀ ਕਰ ਲਿਆ ਪਰ ਉਹ ਕਾਲ ਤੱਕ ਨਹੀਂ ਚੱਕ ਰਿਹਾ ਮੈਨੂੰ ਇਸ ਗੱਲ ਤੋਂ ਬਹੁਤ ਗੁੱਸਾ ਆ ਰਿਹਾ ਹੈ ਮੇਰੇ ਕੋਲ ਇੰਨਾਂ ਟਾਈਮ ਨਹੀਂ ਹੈ ਕਿ ਮੈਂ ਇੱਥੇ ਖੜ੍ਹਾ ਉਹਦੀ ਵੇਟ ਕਰਦਾ ਰਹਾਂ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਹੈ ਮੈਨੂੰ ਨਹੀਂ ਪਤਾ ਕਿ ਉਹ ਕਿੱਥੋਂ ਰਹਿ ਕਿੱਥੇ ਰਹਿ ਗਿਆ ਮ ਮੈਂ ਕਾਫ਼ੀ ਦੇਰ ਤੱਕ ਵੇਟ ਕਰ ਰਿਹਾ ਹਾਂ ਲੇਕਿਨ ਮੈਨੂੰ ਉਸਦਾ ਨਾ ਹੀ ਕਾਲ ਆ ਰਿਹਾ ਨਾ ਹੀ ਉਹ ਕਾਲ ਚੱਕ ਰਿਹਾ ਅਤੇ ਮੈਂ ਕਾਫ਼ੀ ਦੇਰ ਤੱਕ ਇੱਥੇ ਹੀ ਖੜ੍ਹਾ ਵੇਟ ਕਰ ਰਿਹਾ ਹਾਂ